ਤਕਨੋਲਜੀ ਨੇ ਬਿਰਦਾਂ ਅਤੇ ਦ੍ਰਿਸ਼ਟੀਹੀਨਾਂ ਦੀ ਬਹੁਤ ਮਦਦ ਕੀਤੀ ਹੈ ਇਹ ਆਰਟੀਫਿਸ਼ਅਲ ਇੰਟੈਲੀਜੈਂਟ ਦੀ ਮਦਦ ਨਾਲ ਲਿਖੀ ਹੋਈ ਚੀਜ਼ ਨੂੰ ਭਾਸ਼ਣ ਵਿੱਚ ਬਦਲ ਦਿੰਦੇ ਹਨ